ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਨਾ ਫਲਿੱਪਕਾਡ ਤੋਂ ਬੋਲਣ ਦੇ ਅੱਛਾ ਭਾਅ ਜੀ ਮੈਂ ਨਾ ਔਡਰ ਬੁੱਕ ਕੀਤਾ ਸੀ ਭਾਅ ਜੀ ਹੀਟਰ ਬੁੱਕ ਕੀਤਾ ਸੀ ਹੈਲਪ ਕੰਪਨੀ ਦਾ ਭਾਅ ਜੀ ਹਾਂਜੀ ਭਾਅ ਜੀ ਮੈਂ ਕਿਹਾ ਵੀ ਠੰਡ ਠੁੰਡ ਬੜੀ ਦਾ ਮੌਸਮ ਚੱਲਣ ਦਿਆ ਵਾ ਹਾਂਜੀ ਅਤੇ ਉਹ ਘਰਦਿਆਂ ਦੇ ਨਾਲੇ ਮੰਮਾ ਦੇ ਸਵੈਲਿੰਗ ਸਵੂਲਿੰਗ ਕੰਮ ਕਰਦੇ ਰਹਿੰਦੇ ਆ ਸਾਰੀ ਦਿਹਾੜੀ ਹਾਂਜੀ ਅਤੇ ਉਹਨਾਂ ਦੇ ਸਵੈਲਿੰਗ ਸਵੂਲਿੰਗ ਹੁੰਦੀ ਹੱਥਾਂ 'ਤੇ ਅਤੇ ਪਾਪਾ ਵੀ ਰਾਤ ਨੂੰ ਫਿਰ ਡਿਊਟੀ ਤੋਂ ਆਉਂਦੇ ਲੇਟ ਅਮੈਂ ਕਿਹਾ ਸਰਦੀਆਂ ਦਾ ਮੌਸਮ ਹੈਗਾ ਥੋੜ੍ਹੇ ਜਿਹੇ ਆ ਗਏ ਉਹਨਾਂ ਨੂੰ ਸਰਦੀ ਨਿੱਘ ਮਿਲ ਜਾਇਆ ਕਰੂਗਾ ਅਤੇ ਮੈਂ ਭਾਅ ਜੀ ਤੁਹਾਡੀ ਉਹ 'ਤੇ ਕੰਪਨੀ 'ਤੇ ਦੇਖਿਆ ਸੀ ਵੀ ਹੀਟਰ ਥੋੜ੍ਹਾ ਜਿਹਾ ਮਿਲ ਵਧੀਆ ਮਿਲਣ ਦਿਆ ਹੀ ਕੰਪਨੀ ਦਾ ਹਾਂਜੀ ਉਹ ਭਾਅ ਜੀ ਮੈਂ ਬੁੱਕ ਕੀਤਾ ਸੀ ਉਹ ਭਾਅ ਜੀ ਹੁਣ ਆ ਤਾਂ ਗਿਆ ਉਹਦਾ ਮੋਡਲ ਨੰਬਰ ਹੈਗਾ ਤਿੰਨ ਸੌ ਦੋ ਹਾਂਜੀ ਭਾਅ ਜੀ ਕੱਲ ਘਰ ਪਹੁੰਚਾ ਤਾਂ ਗਿਆ ਭਾਅ ਜੀ ਡਿਲੀਵਰੀ ਵਾਲਾ ਪਰ ਜਦੋਂ ਮੈਂ ਉਹਨੂੰ ਚਲਾਇਆ ਖੋਲ੍ਹ ਕੇ ਦੇਖਿਆ ਪਹਿਲਾਂ ਤਾਂ ਭਾਅ ਜੀ ਉਹ ਪੰਜ ਦਸ ਮਿੰਟ ਪਹਿਲਾਂ ਪੰਦਰਾਂ ਮਿੰਟ ਤਾਂ ਸਟਾਰਟ ਨਹੀਂ ਹੋਇਆ ਅਤੇ ਜਦੋਂ ਇਹ ਸਟਾਰਟ ਹੋਇਆ ਥੋੜ੍ਹਾ ਜਿਹਾ ਚੱਲਿਆ ਪੰਜ ਨੰਬਰ 'ਤੇ ਕਰਕੇ ਦੇਖਿਆ ਭਾਈ ਮੈਂ ਪਰ ਉਹਦਾ ਕੋਈ ਨਿੱਘ ਹੀ ਨਹੀਂ ਮਿਲਣ ਦਿਆ ਹੀ ਥੋੜ੍ਹਾ ਇੰਨਾ ਫਰਕ ਨਹੀਂ ਲੱਗਣ ਦਿਆ ਹੀ ਇੱਦਾਂ ਲੱਗਣ ਦਿਆ ਹੀ ਵੀ ਜਿਵੇਂ ਦੋ ਤਿੰਨ ਨੰਬਰ 'ਤੇ ਚੱਲਣ ਦਿਆ ਤਾ ਭਾਈ ਦੇਖਣ 'ਚ ਕੁਛ ਹੋਰ ਸੀ ਸਮਾਨ ਉੱਤੇ ਫੈਨ ਪੱਖਾ ਵੀ ਲੱਗਾ ਸੀ ਪਹਿਲਾਂ ਉੱਤੇ ਅਤੇ ਜਦੋਂ ਨਿਕਲਿਆ ਉਹਦੇ ਵਿੱਚ ਪੱਖਾ ਵੀ ਨਹੀਂ ਲੱਗਾ ਸੀ ਇਕੱਲਾ ਉਹ ਤਾਂ ਦਾ ਸੀ ਮੈਂ ਭਾਅ ਜੀ ਆ ਥੋੜ੍ਹਾ ਜਿਹਾ ਉਦਾਂ ਵੀ ਇਲੈਟ੍ਰੀਕਲ ਦਾ ਕੰਮ ਕਰ ਲੈਂਦਾ ਥੋੜ੍ਹਾ ਜਿਹਾ ਅਤੇ ਮੈਂ ਕਰਕੇ ਦੇਖਿਆ ਨਾ ਵੈਰਿੰਗ ਨਾਲ ਪੰਗੇ ਪੁੰਗੇ ਲੈ ਕੇ ਦੇਖੇ ਪਰ ਨਹੀਂ ਭਾਅ ਜੀ ਗੱਲ ਨਹੀਂ ਬਣੀ ਪਤਾ ਨਹੀਂ ਕੀ ਹੋਇਆ ਵੀ ਉਹ ਚੱਲਣ ਨਹੀਂ ਦਿਆ ਹੁਣ ਫਿਰ ਉਦਾਂ ਕਰਕੇ ਹਾਂਜੀ ਅਤੇ ਮੈਂ ਅਤੇ ਭਾਅ ਜੀ ਇਹੋ ਹੀ ਦੱਸੂੰਗਾ ਬੜਾ ਨਿਰਾਸ਼ ਵਾਲੀ ਗੱਲ ਹੋਈ ਆ ਤੁਹਾਨੂੰ ਨੈਗਟੀਵ ਨੈਗਟੀਵ ਹੀ ਦਉਂਗਾ ਵਿਊ ਹਾਂਜੀ ਮੈਂ ਤਾਂ ਤੁਹਾਡੇ ਉੱਥੇ ਫੀਡਬੈਕ 'ਤੇ ਵੀ ਜਾ ਕੇ ਲਿਖੂੰਗਾ ਵੀ ਨਹੀਂ ਇਹ ਵਧੀਆ ਨਹੀਂ ਹੈਗੀ ਕੰਪਨੀ ਦਾ ਵੀ ਇਹਨਾਂ ਨੇ ਵਧੀਆ ਨਹੀਂ ਦਿੱਤਾ ਹਾਂਜੀ ਅਤੇ ਨਾਲੇ ਮੈਂ ਆਪਣੇ ਯਾਰ ਫਰੈਂਡ ਨੂੰ ਵੀ ਦੱਸੂੰਗਾ ਉਹਨਾਂ ਨੂੰ ਵੀ ਨਹੀਂ ਇੱਥੋਂ ਨਾ ਲਿਓ ਅੱਗੇ ਤੋਂ ਚੀਜ਼ ਹਾਂਜੀ ਅਤੇ ਭਾਅ ਜੀ ਹੁਣ ਦੱਸੋ ਮੈਂ ਫਿਰ ਕੀ ਕਰਾਂ ਮੈਂ ਤਾਂ ਭਾਅ ਜੀ ਇਹੋ ਹੀ ਕਹੂੰਗਾ ਵੀ ਇਹ ਕੰਪਨੀ ਤੋਂ ਅੱਗੇ ਤੋਂ ਕੋਈ ਵੀ ਜਣੇ ਸਮਾਨ ਨਾ ਖਰੀਦਣ ਹਾਂਜੀ ਓਕੇ ਥੈਂਕ ਯੂ ਬਾਈ